ਚਿੱਤਰਕਾਰੀ ਨੂੰ ਪੇਂਟਿੰਗ ਵੀ ਕਿਹਾ ਜਾਂਦਾ ਹੈ ਮੈਂ ਆਪਣੇ ਬਚਪਨ ਤੋਂ ਹੀ ਚਿੱਤਰਕਾਰੀ ਕਰ ਰਹੀ ਹਾਂ ਮੈਨੂੰ ਚਿੱਤਰਕਾਰੀ ਕਰਨਾ ਪਸੰਦ ਹੈ ਅੱਜ ਕੱਲ੍ਹ ਚਿੱਤਰਕਾਰੀ ਕਰਨ ਲਈ ਯੂਟਿਊਬ 'ਤੇ ਬਹੁਤ ਸਾਰੀ ਵੀਡੀਓਜ਼ ਮੌਜ਼ੂਦ ਹਨ ਜਿਸ ਤੋਂ ਆਪਾਂ ਬੇਸਿਕ ਤੋਂ ਲੈ ਕੇ ਐਂਡ ਤੱਕ ਪੂਰੇ ਪ੍ਰਫੈਸ਼ਨਲ ਤੱਕ ਦੀ ਚਿੱਤਰਕਾਰੀ ਸਿੱਖ ਸਕਦੇ ਹਾਂ ਅਤੇ ਪੇਂਟਿੰਗ ਦਾ ਅਭਿਆਸ ਸਿਰਫ ਔਰ ਸਿਰਫ ਉਸਨੂੰ ਕਰਨਾ ਦਿਨ ਰਾਤ ਮਿਹਨਤ ਕਰਨਾ ਉਸਨੂੰ ਪੜ੍ਹਨਾ ਅਤੇ ਉਸਨੂੰ ਸਮਝਣ ਨਾਲ ਹੈ ਜਿੰਨਾਂ ਅਸੀਂ ਪੇਂਟਿੰਗ ਅਤੇ ਚਿੱਤਰਕਾਰੀ ਦਾ ਅਭਿਆਸ ਕਰਾਂਗੇ ਉੱਨਾਂ ਅਸੀਂ ਇੱਕ ਚੰਗੇ ਚਿੱਤਰਕਾਰ ਬਣ ਸਕਦੇ ਹਾਂ